ਮੈਂ ਲਿਖਣ 'ਤੇ ਖੁਦ ਨੂੰ ਪ੍ਰੇਰਿਤ ਰੱਖਣ ਦੇ ਲਈ ਜ਼ਿਆਦਾਤਰ ਖੁਦ ਨੂੰ ਸ਼ਾਂਤ ਰੱਖਦੀ ਹਾਂ ਸਭ ਤੋਂ ਪਹਿਲਾਂ ਮੈਂ ਆਪਣੇ ਆਪ ਨੂੰ ਸ਼ਾਂਤ ਕਰਦੀ ਹਾਂ ਅਤੇ ਮੈਂ ਨਿਯਮਤ ਤੌਰ 'ਤੇ ਹੀ ਆ ਜੋ ਨਾਵਲ ਹੈ ਲਿਖਦੀ ਰਹਿੰਦੀ ਹਾਂ ਔਰ ਜੋ ਮੇਰੇ ਨਾਵਲ ਹੁੰਦੇ ਆ ਉਹ ਜ਼ਿਆਦਾਤਰ ਔਰਤਾਂ ਦੇ ਹੈਲਥ ਉੱਤੇ ਹੁੰਦੇ ਹਨ ਅਤੇ ਮੈਂ ਹਿੰਦੀ ਅਤੇ ਪੰਜਾਬੀ ਭਾਸ਼ਾ ਦੋਨਾਂ ਦੇ ਵਿੱਚ ਹੀ ਹੈ ਨਾਵਲ ਜਾਂ ਆਰਟੀਕਲ ਜੋ ਹੈ ਮੈਂ ਲਿਖਦੀ ਹਾਂ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਆਪਣੇ ਆਰਟੀਕਲ ਦੇ ਵਿੱਚ ਡਾਕਟਰ ਦੀ ਹਰ ਬਾਈਟ ਨੂੰ ਲਿਖਾਂ ਤਾਂ ਕਿ ਲੋਕਾਂ ਨੂੰ ਬਹੁਤ ਚੰਗੀ ਤਰ੍ਹਾਂ ਸਮਝ ਆਵੇ ਕਿ ਜੋ ਪ੍ਰੋਬਲਮ ਬਾਰੇ ਮੈਂ ਡਿਸਕਸ ਕਰ ਰਹੀ ਹਾਂ ਉਹ ਅ ਅਸਲ 'ਚ ਹੈ ਕੀ ਹੈ ਅਤੇ ਮੇਰੇ ਆਰਟੀਕਲ ਦੇ ਵਿੱਚ ਹੈਲਥ ਤੋਂ ਇਲਾਵਾ ਬਿਊਟੀ ਅਤੇ ਫੈਸ਼ਨ ਵੀ ਹੁੰਦਾ ਹੈ ਬਿਊਟੀ ਅਤੇ ਫੈਸ਼ਨ ਮੈਂ ਜੋ ਲਿਖਦੀ ਹਾਂ ਉਹ ਜ਼ਿਆਦਾਤਰ ਬੋਲੀਵੁੱਡ ਐਕਟਰਸ ਉੱਤੇ ਪ੍ਰਭਾਵਿਤ ਹੁੰਦਾ ਹੈ ਕਿ ਉਹ ਆਪਣੇ ਦਿਨ ਚਰਿਆ ਨੂੰ ਕਿਵੇਂ ਦੇਖਦੇ ਨੇ ਅਤੇ ਉਹਨਾਂ ਦੇ ਜੋ ਬਿਊਟੀ ਸੀਕਰੇਟ ਹੁੰਦੇ ਨੇ ਉਹ ਕਿਹੜੇ ਹੁੰਦੇ ਨੇ ਜਿਹੜੇ ਤੁਸੀਂ ਆਮ ਆਮ ਘਰਾਂ ਦੀਆਂ ਔਰਤਾਂ ਵੀ ਅਪਣਾ ਸਕਦੀਆਂ ਹਨ ਅਤੇ ਫੈਸ਼ਨ ਦੀ ਗੱਲ ਕਰੀਏ ਤਾਂ ਮੇਰੇ ਫੈਸ਼ਨ ਦੇ ਵਿੱਚ ਜ਼ਿਆਦਾਤਰ ਇੰਡੀਅਨ ਡਿਜ਼ਾਇਨਰ ਹੁੰਦੇ ਨੇ ਜਿਵੇਂ ਕਿ ਮਨੀਸ਼ ਮਲਹੌਤਰਾ ਸਭਿਆਸਾਚੀ ਇਹਨਾਂ ਦੇ ਕੱਪੜੇ ਮੈਨੂੰ ਪਸੰਦ ਆਉਂਦੇ ਨੇ ਅਤੇ ਲੋਕਾਂ ਨੂੰ ਵੀ ਇਹ ਬਹੁਤ ਹੀ ਜ਼ਿਆਦਾ ਪਸੰਦ ਆਉਂਦੇ ਨੇ ਬੋਲੀਵੁਡ ਵਿੱਚ ਤਾਂ ਇੱਕ ਇਹਨਾਂ ਦਾ ਬਹੁਤ ਹੀ ਵੱਡਾ ਨਾਮ ਹੈ ਇਹ ਆਪਣੇ ਕੱਪੜਿਆਂ ਦੇ ਦਮ 'ਤੇ ਹੀ ਸਾਰੀ ਦੁਨੀਆਂ ਦੇ ਰਾਜ ਕਰ ਰਹੇ ਨੇ ਆਹ ਸੱਭਿਆ ਸਾਚੀ ਦੇ ਕੱਪੜੇ ਵਿੱਚ ਤੁਹਾਨੂੰ ਭਾਰਤੀ ਟਰਡੀਸ਼ਨ ਦੀ ਇੱਕ ਝਲਕ ਦੇਖਣ ਨੂੰ ਮਿਲਦੀ ਹੈ ਇਹ ਕੱਪੜੇ ਬਹੁਤ ਹੀ ਸੋਹਣੇ ਹੁੰਦੇ ਆ ਬਰਾਈਡਲ ਕੱਪੜਿਆਂ ਦੀ ਗੱਲ ਕਰੀਏ ਅਤੇ ਇਹ ਦੇਖਣ 'ਚ ਬਹੁਤ ਪਿਆਰੇ ਲੱਗਦੇ ਨੇ